ਹਾਂ ਹੈਲੋ ਮੈਮ ਸਤਿ ਸ਼੍ਰੀ ਅਕਾਲ ਕੀ ਹਾਲ ਨੇ ਮੈਮ ਬਸ ਵਧੀਆ ਵਧੀਆ ਮੈਮ ਅਤੇ ਮੈਮ ਵੈਲਕਮ ਟੂ ਕਰਤਾਰਪੁਰ ਪਾਕਿਸਤਾਨ ਅਤੇ ਤੁਸੀਂ ਪਹਿਲੀ ਵਾਰ ਆ ਰਹੇ ਹੋ ਮੈਮ ਇੱਥੇ ਠੀਕ ਹੈ ਮੈਮ ਹੈ ਦੇਖੋ ਜੀ ਤੁਸੀਂ ਵੈਸੇ ਹਾਂਜੀ ਬਿਲਕੁਲ ਮੈਮ ਬਿਲਕੁਲ ਅਤੇ ਥੈਂਕ ਯੂ ਮੈਮ ਬਾਕੀ ਮੈਂ ਰਵਿੰਦਰ ਹਮੇਸ਼ਾ ਕਾਫ਼ੀ ਸਮੇਂ ਤੋਂ ਮੈਂ ਸਾਰੇ ਜਿੰਨੇ ਵੀ ਟੂਰਿਸਟ ਆਉਂਦੇ ਨੇ ਉਹਨੂੰ ਗਾਈਡ ਕਰਦਾ ਆ ਰਿਹਾ ਅਤੇ ਮੈਂ ਜਾਣਨਾ ਚਾਹੁੰਦਾ ਕਿੱਥੋਂ ਆਏ ਹੋ ਪੰਜਾਬ ਤੋਂ ਆਏ ਹੋ ਮੈਮ ਅੱਛਾ ਲੁਧਿਆਣਾ ਪਾਸੋਂ ਆਏ ਹੋ ਠੀਕ ਹੈ ਠੀਕ ਹੈ ਮੇਰੇ ਰਲੇਟਿਵ ਵੀ ਲੁਧਿਆਣਾ ਰਹਿੰਦੇ ਨੇ ਅਤੇ ਹਾਂਜੀ ਮੋਡਲ ਟਾਊਨ ਸਾਈਡ ਰਹਿੰਦੇ ਨੇ ਅਤੇ ਈਵਨ ਤੁਸੀਂ ਹਾਂਜੀ ਤੁਸੀਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਵੇਖਣ ਆਏ ਹੋ ਐ ਅਤੇ ਲੁਧਿਆਣਾ 'ਚ ਵੀ ਬੜਾ ਵਧੀਆ ਬਣਿਆ ਹੋਇਆ ਜਿਹੜਾ ਮੇਰੇ ਖਿਆਲ ਤੋਂ ਜਿਹੜੇ ਜਿੱਥੇ ਆਉਂਦੇ ਹਾਂ ਅਸੀਂ ਨਾਲ ਅਸੀਂ ਕਵਰ ਕਰਦੇ ਹਾਂ ਚੱਲਦੇ ਹਾਂ ਅੰਦਰ ਅਸੀਂ ਹੈ ਨਾ ਦਿਖਾ ਦਿੰਦਾ ਇੱਕ ਵਾਰੀ ਕੀ ਕੀ ਪਲੇਸਿਸ ਨੇ ਨਾਲ ਲੁਧਿਆਣਾ 'ਚ ਵੀ ਬਣਿਆ ਹੋਇਆ

ਬਿਲਕੁਲ ਬਿਲ ਮੈਂ ਤੁਹਾਨੂੰ ਦੱਸ ਦਿੰਦਾ ਸਾਰਾ ਅਤੇ ਇੱਕ ਚੱਲੋ ਤੁਸੀਂ ਲੁਧਿਆਣਾ ਤੋਂ ਆਏ ਹੋ ਅਤੇ ਲੁਧਿਆਣਾ ਤਾਂ ਪਹਿਲੇ ਹੀ ਜਿਹੜਾ ਨੀਅਰ ਹੈਗਾ ਨਾ ਆਪਣਾ ਮੈਟਰੋ ਰੋਡ ਜਾਂਦੀ ਜਿਹੜੀ ਜਲੰਧਰ ਬਾਏਪਾਸ ਤੋਂ ਉੱਥੇ ਲੁਧਿਆਣਾ ਦਾ ਬੜਾ ਵਧੀਆ ਬਣਿਆ ਮਹਾਰਾਜਾ ਸਿੰਘ ਜੀ ਹਾਂ ਅਤੇ ਇੱਕ ਅੰਮ੍ਰਿਤਸਰ ਬਣਿਆ ਹੋਇਆ ਬਹੁਤ ਵਧੀਆ ਹਾਂਜੀ ਅਤੇ ਉੱਥੇ ਪਿਛਲੀ ਤੁਹਾਨੂੰ ਹਿਸਟਰੀ ਅਗਰ ਦੱਸਾਂ ਥੋੜ੍ਹਾ ਜਿਹਾ ਜਿੱਦਾਂ ਤੁਸੀਂ ਦੇਖ ਰਹੇ ਆ ਅਸੀਂ ਜਿੱਦਾਂ ਸੀਨਰੀ ਦੇਖ ਰਹੇ ਹਾਂ ਸਾਹਮਣੇ ਤੁਹਾਨੂੰ ਨਜ਼ਰ ਰੱਖਣੀ ਪਵੇਗੀ ਅਤੇ ਮਹਾਰਾਜਾ ਰਣਜੀਤ ਸਿੰਘ ਜਿਹੜੇ ਸੀਗੇ ਨਾ ਉਹ ਆਪਣੇ ਇੱਕ ਬੇਸਿਕਲੀ ਜਿਹਨਾਂ ਦੀ ਇੱਕ ਹਿਸਟਰੀ ਬਣੀ ਹੋਈ ਹੈ ਜਿਹੜੀ ਨਾਈਨਟੀ ਸੈਵਨਟੀ ਸੈਵਨ ਤੋਂ ਚੱਲਦੀ ਆ ਰਹੀ ਹੈ ਅਤੇ ਇਹ ਜਿਹੜਾ ਨਾਈਨਟੀ ਤੱਕ ਹਾਂਜੀ ਜਿੱਦਾਂ ਕਰਤਾਰਪੁਰ ਹੈਗਾ ਅੰਮ੍ਰਿਤਸਰ ਹੈਗਾ ਜਾਂ ਲੁਧਿਆਣਾ ਇਹ ਬੇਸਿਕਲੀ ਨਾਈਨਟੀਨ ਸੈਨਚੂਰੀ ਏਟੀਨ ਤੋਂ ਨਾਈਨਟੀਨ ਸੈਨਚੂਰੀ ਤੋਂ ਬਣਿਆ ਹੋਇਆ ਠੀਕ ਹੈ ਅਤੇ ਬੇਸਿਕਲੀ ਬ੍ਰਿਕ ਸਿੱਖ ਜਿਹੜੀ ਕਮਿਊਨਿਟੀ ਨੂੰ ਪ੍ਰਜੈਂਟ ਕਰਦੇ ਹਾਂ ਅਸੀਂ ਸਾਰਾ ਅਤੇ ਉਹਦੇ ਨਾਲ ਆਪਾਂ ਤੁਹਾਨੂੰ ਦੱਸਦਾ ਇਹਦੇ ਬਾਰੇ ਕਿ ਜਿੰਨੇ ਵੀ ਅਸੀਂ ਪੇਂਟਿੰਗ ਦੇਖ ਰਹੇ ਹੋ ਹੈ ਨਾ ਸਾਰੀਆਂ ਇਹ ਜਿਹੜੇ ਪੇਂਟਿੰਗਸ ਡਿਸਪਲੇਅ ਕੀਤੀਆਂ ਜਾ ਰਹੀਆਂ ਨੇ ਇਹ ਬੇਸਿਕਲੀ ਉਹਨਾਂ ਦੇ ਕੋਰਟ ਐਂਡ ਜਿਹੜੇ ਅਸੀਂ ਜਿਹੜੇ ਕਿੰਗ ਸੀਗੇ ਜਿਹੜੇ ਰਾਜਾ ਸੀਗੇ ਇਹ ਪੂਰਾ ਜਿੰਨਾ ਵੀ ਅਸੀਂ ਸਿੱਖ ਕਮਿਊਨਿਟੀ ਨੂੰ ਉਹਨਾਂ ਨੇ ਪ੍ਰਜੈਂਟ ਕੀਤਾ ਸਭ ਨੂੰ ਦੱਸਿਆ ਸਾਰਾ ਕਿ ਕਿੱਦਾਂ ਕਿੱਦਾਂ ਵੀ ਇਸ ਚੀਜ਼ ਨੂੰ ਅਸੀਂ ਅੱਗੇ ਦੇਖ ਸਕਦੇ ਹਾਂ ਈਵਨ ਇਹਦੇ ਇਲਾਵਾ ਮਿਊਜਿੰਗ ਇਹਦੇ ਅੰਦਰ ਬੜਾ ਵਧੀਆ ਬਿਊਟੀਫੁਲ ਬਣਿਆ ਹੋਇਆ ਅਤੇ ਤੁਸੀਂ ਦੇਖੋ ਇਹਦਾ ਰਿਕੋਰਡ ਦੇਖੋ ਇਹ ਦੇਖੋ ਸੀਨਰੀਆਂ ਦੇਖੋ ਹਾਂਜੀ ਬਿਲਕੁਲ ਬਿਲਕੁਲ ਮੈਮ ਅਤੇ ਇਹਦੇ ਇਲਾਵਾ ਇਹਦੇ ਅੰਦਰ ਅਸੀਂ ਚੱਲਦੇ ਹਾਂ ਅੱਗੇ ਅਤੇ ਦੇਖੋ ਇਹਨਾਂ ਦੇ ਜਿਹੜੇ ਜਿਹੜੇ ਹੈਗੇ ਨੇ ਜੋ ਜਿਹਨਾਂ ਨੇ ਜਿਹੜੇ ਵਸਤਰ ਨੇ ਇਹ ਇਹਨਾਂ ਦੇ ਹਮੇਸ਼ਾ ਬਹੁਤ ਵਧੀਆ ਤਰੀਕੇ ਨਾਲ ਪਾਉਂਦੇ ਨੇ ਅਤੇ ਇਹਦੇ ਇਲਾਵਾ ਅਸੀਂ ਅਗਰ ਗੱਲ ਕਰੀਏ ਤਾਂ ਇਹ ਦੇਖੋ ਇਹਨਾਂ ਦੀ ਸੀਨਰੀਆਂ ਦੇ ਨਾਲ ਨਾਲ ਇਹ ਦੇਖੋ ਗਾਰਡਨ ਜਿਹੀ ਬਣਿਆ ਹੋਇਆ ਹੈ ਰੀਪ੍ਰਜੈਂਟ ਕਰਦਾ ਬੱਚਿਆਂ ਨੂੰ ਵੀ ਕਿੱਦਾਂ ਅਸੀਂ ਅੱਗੇ ਤੱਕ ਜਾ ਸਕਦੇ ਹਾਂ ਬਿਲਕੁਲ ਬਿਲਕੁਲ ਐਮ ਐਮ ਨਾਈਨਟੀ ਸਿਕਟੀ ਏਟ ਤੋਂ ਟਿਲ ਏਟੀਨ ਫੋਰਟੀ ਨਾਈਨ ਤੋਂ ਲਾਹੌਰ ਦੇ ਅੰਦਰ ਹੈਗਾ ਆ ਜਿਹੜਾ ਹਾਂਜੀ ਹਾਂਜੀ ਅਤੇ ਇਹਦੇ ਇਲਾਵਾ ਲਾਹੌਰ ਦੇ ਅੰਦਰ ਨਾ ਕੈਪੀਟਲ ਹੈਗਾ ਲਾਹੌਰ ਦਾ ਜਿਹਦੇ ਅੰਦਰ ਰੀਵਰ ਸਤਲੁਜ ਜਿਹੜੀ ਹੈਗੀ ਨਾ ਉਹ ਇੱਧਰੋਂ ਹੀ ਜਾਂਦੀ ਹੈ ਜੇ ਕਾਬੁਲ ਤੋਂ ਹੁੰਦੇ ਹੋਏ ਹਾਂਜੀ ਇਹ ਚੀਜ਼ਾਂ ਤਾਂ ਇਹਦੇ ਇਲਾਵਾ ਤੁਹਾਨੂੰ ਦੱਸਦਾ ਇਹ ਸੱਠ ਹਜ਼ਾਰ ਅਪਰੋਕਸੀਮੇਟਲੀ ਇਹਦੇ ਨਾ ਜਿਹੜੀ ਹਿਸਟਰੀਕਲ ਕਲਚਰ ਬਣਿਆ ਹੋਇਆ ਹੈਗਾ ਸੱਠ ਹਜ਼ਾਰ ਦਾ ਹਾਂਜੀ ਹਾਂਜੀ ਅਤੇ ਇਹ ਸਾਰੀ ਜਿੰਨੀ ਵੀ ਤੁਸੀਂ ਸਕੈਚ ਦੇਖ ਰਹੇ ਹੋ ਹੈ ਨਾ ਇਹ ਸਾਰਾ ਰੀਪ੍ਰਜੈਂਟ ਕਰਦਾ ਥੋੜ੍ਹਾ ਬਹੁਤ ਕਹਿ ਲਓ ਕਿ ਅਸੀਂ ਕਹਿ ਸਕਦੇ ਹਾਂ ਕਿ ਬੁੱਧਿਸਟ ਸਿੱਖ ਨੂੰ ਵੀ ਇਹ ਚੀਜ਼ਾਂ ਦਿਖਾ ਰਿਹਾ ਹਿੰਦੂ ਵੀ ਆ ਰਹੇ ਨੇ ਜੈਨ ਵੀ ਆ ਰਹੇ ਨੇ ਇਹ ਪੂਰਾ ਇਲਸਲਾਮਿਕ ਨੂੰ ਸ਼ੋਅ ਕਰ ਰਿਹਾ ਇਹਦੇ ਅੰਦਰ

ਠੀਕ ਹੈ ਮੈਮ ਮੈਂ ਹੋਪ ਸੋ ਤੁਹਾਨੂੰ ਸਮਝ ਆ ਗਿਆ ਹੋਵੇਗਾ ਬਾਕੀ ਨੈਕਸਟ ਫਿਰ ਆਉਂਣਾ ਫੈਮਲੀ ਨਾਲ ਫਿਰ ਦੇਖਦੇ ਹਾਂ ਅਸੀਂ ਓਕੇ ਓਕੇ ਜੀ ਓਕੇ ਵੈਲਕਮ ਜੀ ਓਕੇ